ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕੌਣ

ਓ ਵੈਰੀ ਗੁਡ ਆਓ ਆਓ ਜ਼ਰੂਰ ਆਓ ਹਾਂਜੀ ਉਰੇ ਗੁਰੂ ਹਰਿਮੰਦਰ ਸਾਹਿਬ ਵੀ ਹੈਗਾ ਆਪਣੇ ਦੁੱਖ ਨਿਵਾਰਨ ਵੀ ਹੈਗਾ ਪਟਿਆਲੇ 'ਚ ਆਪਣੇ ਅਤੇ ਕਿਲ੍ਹਾ ਮੁਬਾਰਕ ਵੀ ਹੈਗਾ ਆਪਣੇ ਦੱਸੋ ਕਦ ਤੱਕ ਆਉਣਾ ਜੀ ਨਹੀਂ ਕਦ ਤੱਕ ਕੱਲ੍ਹ ਪਰਸੋਂ ਹਾਂਜੀ ਹਾਂਜੀ ਆਪਣੇ ਪਟਿਆਲੇ ਫੇਮਸ ਆ ਪੰਜਾਬੀ ਜੁੱਤੀ ਉਰੇ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਜੁੱਤੀ ਮਿਲ ਜਾਂਦੀ ਹੈ ਸੋਨੇ ਚਾਂਦ ਹਾਂਜੀ ਲੱਗੇ ਹੋਏ ਜੜੇ ਹੋਏ

ਔਰ ਉਰੇ ਆਪਣੀ ਕਿਲ੍ਹਾ ਵੀ ਹੈ ਜਿੱਥੇ ਪੁਰਾਣੇ ਰਾਜੇ ਰਹਿੰਦੇ ਸੀਗੇ ਅਤੇ ਉਰੇ ਦੁੱਖ ਨਿਵਾਰਨ ਵੀ ਹੈਗਾ ਆਪਣੇ ਮੱਥਾ ਟੇਕਣ ਨੂੰ ਹਾਂਜੀ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਅਤੇ ਉਰੇ ਆਪਣਾ ਮੰਦਰ ਵੀ ਹੈ ਆਪਣਾ ਕਾਲੀ ਮਾਤਾ ਮੰਦਰ ਘੁੰਮਣ ਨੂੰ ਉਰੇ ਮੌਲ ਵੀ ਹੈ ਮੌਲ ਹੋ ਗਿਆ ਆਪਣੇ ਔਰ ਬਹੁਤ ਚੀਜ਼ਾਂ ਨੇ

ਇਹ ਇਹ ਆਪਣੇ ਪਟਿਆਲੇ 'ਚ ਨੇ ਜੀ ਸ਼ੇਰਾ ਵਾਲਾ ਗੇਟ ਵੱਜਦਾ ਸਾਡੀ ਉੱਥੇ ਦੁਕਾਨ ਹੈ ਹਾਂਜੀ ਹਾਂਜੀ ਹਾਂਜੀ ਪੰਜਾਬੀ ਜੁੱਤੀ ਵੀ ਪਟਿਆਲੇ ਮਿਲ ਜਾਏਗੀ ਸੂਟ ਸਲਵਾਰ ਵੀ ਮਿਲ ਸਕਦਾ ਅਤੇ ਤੁਹਾਡੇ ਵਾਈਫ ਨੂੰ ਪਸੰਦ ਹੋਣ ਹਾਂਜੀ ਇੱਕ ਤੋਂ ਇੱਕ ਇੱਕ ਤੋਂ ਇੱਕ ਵਰਾਈਟੀ ਮਿਲ ਸਕਦੀ ਹੈ ਤੁਹਾਨੂੰ ਉਰੇ ਹਾਂਜੀ ਹਾਂਜੀ ਸਰ ਆਪਣਾ ਨਾਮ ਦੱਸ ਦਿੰਦੇ ਠੀਕ ਹੈ ਜੀ